ਸਤਿ ਸ਼੍ਰੀ ਅਕਾਲ ਜੀ ਮੇਰਾ ਇਸ 'ਤੇ ਇਹ ਵਿਚਾਰ ਹੈ ਕਿ ਕੁਝ ਕਰ ਹੀ ਪਰਸੈਂਟ ਲੋਕ ਜਿਹੜੇ ਆ ਉਹ ਕੰਮ ਕਰਦੇ ਹਨ ਬਾਕੀ ਸਾਰੇ ਹੀ ਆਪਣੇ ਆਪਣੇ ਬਿਜ਼ਨਸ ਜਾਂ ਫਿਰ ਆਪਣੇ ਹੀ ਵਪਾਰ ਨੂੰ ਸੰਭਾਲਦੇ ਹਨ ਆਪਣੀ ਖੇਤੀਬਾੜੀ ਨੂੰ ਸੰਭਾਲਦੇ ਹਨ ਪੰਜਾਬ 'ਚ ਪੰਜਾਹ ਪਰਸੈਂਟ ਜਿਹੜੇ ਬੱਚੇ ਹੈਗੇ ਆ ਉਹ ਬਾਹਰ ਚੱਲ ਜਾਂਦੇ ਆ ਬਾਹਰ ਜਾ ਕੇ ਜੋ ਵੀ ਕੰਮਕਾਰ ਕਰਦੇ ਹਨ ਕੁਝ ਕੁ ਨੂੰ ਨੌਕਰੀ ਮਿਲਦੀ ਆ ਅਤੇ ਬਾਕੀ ਤਾਂ ਸਾਰੇ ਆਪਣਾ ਹੀ ਬਿਜ਼ਨਸ ਕਰਦੇ ਹਨ ਅਤੇ ਆਪਣੇ ਹੀ ਕੰਮਕਾਰਾਂ ਨੂੰ ਦੇਖਦੇ ਹਨ